ਮੇਰਾ ਮਨਪਸੰਦ ਇੱਕ ਨਾਟਕ ਆ ਟੈਰਰਿਸਟ ਦੀ ਪ੍ਰੇਮਿਕਾ ਜੋ ਪਾਲੀ ਭੁਪਿੰਦਰ ਜੀ ਦਾ ਲਿਖਿਆ ਹੋਇਆ ਹੈ ਇਸ ਵਿੱਚ ਅਨੀਤ ਨਾਂ ਦੀ ਕੁੜੀ ਹੁੰਦੀ ਹੈ ਜਿਸ ਦਾ ਇੱਕ ਪੁਲਿਸ ਅਫਸਰ ਨਾਲ ਵਿਆਹ ਹੋਇਆ ਹੁੰਦਾ ਉਹ ਦੌਰ ਇੱਦਾਂ ਦਾ ਕਿ ਉਦੋਂ ਆਤੰਕਵਾਦ ਦਾ ਦੌਰਾ ਜਦੋਂ ਕਿਸੇ ਨੂੰ ਮਾਰ ਦੇਣਾ ਕੋਈ ਇੰਨੀ ਬਹੁਤ ਹੀ ਵੱਡੀ ਗੱਲ ਨਹੀਂ ਸਮਝਿਆ ਜਾਂਦਾ ਉਹਨੂੰ ਰਫਾ ਦਫਾ ਕਰ ਦਿੱਤਾ ਜਾਂਦਾ ਅਤੇ ਉਸ ਦਾ ਜੋ ਹਸਬੈਂਡ ਆ ਉਹ ਮਤਲਬ ਆਪਣੀ ਨੌਕਰੀ ਸਹੀ ਢੰਗ ਨਾਲ ਨਹੀਂ ਕਰਦਾ ਪਰ ਉਹਨੂੰ ਇੱਦਾਂ ਲੱਗਦਾ ਕਿ ਮੇਰੇ ਘਰ ਵਾਲਾ ਤਾਂ ਬਹੁਤ ਵਧੀਆ ਇਨਸਾਨ ਆ ਉਹ ਆਪਣੀ ਨੌਕਰੀ ਬਹੁਤ ਹੀ ਇਮਾਨਦਾਰੀ ਨਾਲ ਕਰਦਾ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਪਰ ਉਹ ਇੱਦਾਂ ਦਾ ਨਹੀਂ ਹੈ ਉਹ ਬਹੁਤ ਸ਼ੱਕੀ ਕਿਸਮ ਦਾ ਆਦਮੀ ਹੈ ਅਤੇ ਉਸਨੇ ਇੱਕ ਕੁੜੀ ਦਾ ਰੇਪ ਕੀਤਾ ਹੁੰਦਾ ਮਤਲਬ ਆਪਣੇ ਹੋਰ ਅਫਸਰਾਂ ਨਾਲ ਰਲ ਕੇ ਅਤੇ ਜਿਹੜਾ ਉਸ ਕੁੜੀ ਦਾ ਰੇਪ ਹੋਇਆ ਹੁੰਦਾ ਉਹਦਾ ਜੋ ਪ੍ਰੇਮੀ ਹੁੰਦਾ ਗਾ ਉਹ ਟੈਰਰਿਸਟ ਬਣ ਕੇ ਉਹਨਾਂ ਦੇ ਘਰੇ ਆ ਜਾਂਦਾ ਅਤੇ ਉਸ ਸਮੇਂ ਉਹ ਪੁਲਿਸ ਅਫਸਰ ਘਰੇ ਨਹੀਂ ਹੁੰਦਾ ਪਰ ਉਸ ਦੀ ਵਾਈਫ ਹੁੰਦੀ ਆ ਅਤੇ ਉਹਨੂੰ ਕਹਿੰਦਾ ਕਿ ਮੈਂ ਤੇਰੇ ਹਸਬੈਂਡ ਨੂੰ ਮਾਰਨ ਆਇਆ ਹੋਇਆ ਅਤੇ ਉਹ ਉਸ ਦੀ ਵਜ੍ਹਾ ਪੁੱਛਦੀ ਪਰ ਉਸਨੂੰ ਯਕੀਨ ਨਹੀਂ ਆਉਂਦਾ ਕਿ ਮੇਰੇ ਘਰ ਵਾਲਾ ਇੱਦਾਂ ਕਰ ਸਕਦਾ ਉਹ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਨਾ ਮਾਰੋ ਉਸ ਨੂੰ ਇਸ ਹੱਦ ਤੱਕ ਪਿਆਰ ਕਰਦੇ ਕਿ ਉਹ ਕਹਿੰਦੀ ਤੁਸੀਂ ਮੇਰੀ ਜਾਨ ਲੈ ਲਓ ਪਰ ਉਹ ਜੋ ਟੈਰੀਰਿਸਟ ਹੁੰਦਾ ਉਹ ਇੱਕ ਟੈਰੀਰਿਸਟ ਨਹੀਂ ਹੁੰਦਾ ਸੀ ਬਹੁਤ ਚੰਗੀਆ ਆਦਤਾਂ ਵੀ ਹੁੰਦੀਆਂ ਨੇ ਪਰ ਉਸਨੂੰ ਨਹੀਂ ਮਾਰਦਾ ਉਹ ਉਸਦੀ ਪ੍ਰੇਮਿਕਾ ਦਾ ਵਾਸਤਾ ਦੇ ਕੇ ਆਪਣੇ ਘਰਵਾਲੀ ਦੀ ਜਾਨ ਨੂੰ ਬਖਸ਼ਾ ਲੈਂਦੀ ਹੈ ਅਤੇ ਉਹ ਉੱਥੋਂ ਚਲਾ ਜਾਂਦਾ ਪਰ ਜਦੋਂ ਉਸਦਾ ਹਸਬੈਂਡ ਆਉਂਦਾ ਅਤੇ ਉਸਨੂੰ ਪਤਾ ਲੱਗਦਾ ਕਿ ਕੋਈ ਅਣਜਾਣ ਆਦਮੀ ਘਰ ਆਇਆ ਸੀ ਅਤੇ ਉਹ ਘੰਟਾ ਡੇਢ ਘੰਟਾ ਰਿਹਾ ਪਰ ਉਸਨੇ ਉਸਦੀ ਵਾਈਫ ਨੂੰ ਕੁਛ ਨਹੀਂ ਕਿਹਾ ਅਤੇ ਉਸ ਨੇ ਉਹ ਇੱਦਾਂ ਦਾ ਕੀ ਕਿਹਾ ਕਿ ਉਹਦੀ ਜਾਨ ਲੈਣਾ ਆਇਆ ਸੀ ਪਰ ਉਹ ਲੈ ਕੇ ਨਹੀਂ ਗਿਆ ਉਸ ਦੀ ਜਾਨ ਕਿ ਉਹ ਆਪਣੇ ਘਰਵਾਲੀ 'ਤੇ ਸ਼ੱਕ ਕਰਦਾ ਹੈ ਅਤੇ ਉਸਨੂੰ ਇਦਾਂ ਲੱਗਦਾ ਕਿ ਉਸਨੇ ਉਸ ਨਾਲ ਕੋਈ ਗਲਤ ਸੰਬੰਧ ਬਣਾਏ ਹਨ ਪਰ ਉਸਦੀ ਵਾਈਫ ਉਸ 'ਤੇ ਇਹਨਾਂ ਯਕੀਨ ਕਰਦੀ ਹੈ ਪਰ ਉਹ ਇੱਕ ਪਲਾਂ ਵਿੱਚ ਉਸਤੇ ਯਕੀਨ ਕਰ ਲੈਂਦਾ ਕਿ ਉਸਨੇ ਕੁਛ ਗਲਤ ਐਕਸ਼ਨ ਕੀਤਾ ਅਤੇ ਉਹ ਜਦੋਂ ਉਸ ਕੁੜੀ ਨੂੰ ਪਤਾ ਲੱਗਦਾ ਕਿ ਉਸਦਾ ਹਸਬੈਂਡ ਇੱਦਾਂ ਦਾ ਕਿਉਂ ਇੰਨਾ ਯਕੀਨ ਕਰਦੀ ਕਿਸੇ ਦੇ ਕਹਿਣ 'ਤੇ ਵੀ ਸਬੂਤ ਦੇਖਣ 'ਤੇ ਵੀ ਉਸ ਨੂੰ ਇੱਦਾਂ ਲੱਗਦਾ ਕਿ ਮੇਰਾ ਘਰ ਵਾਲਾ ਕਦੇ ਗਲਤ ਨਹੀਂ ਕਰ ਸਕਦਾ ਪਰ ਉਹ ਇੱਕ ਡੇਢ ਘੰਟੇ 'ਤੇ ਉਸ ਨੂੰ ਇਹ ਲੱਗਦਾ ਕਿ ਮੇਰੀ ਘਰਵਾਲੀ ਗਲਤ ਆ ਇਸ ਵਿੱਚ ਇਹ ਦੱਸਿਆ ਗਿਆ ਲਾਸਟ 'ਤੇ ਉਹ ਇੱਦਾਂ ਹੁੰਦਾ ਕਿ ਉਹ ਕੁੜੀ ਇੰਨਾ ਪਿਆਰ ਕਰਨ ਵਾਲੀ ਇੰਨੀ ਸਹਿਣਸ਼ੀਲ ਲਿਟਰੇਚਰ ਨਾਲ ਜੁੜੀ ਹੋਈ ਕੁਦਰਤ ਨਾਲ ਜੁੜੀ ਹੋਈ ਕੁੜੀ ਆਪਣੇ ਘਰ ਵਾਲੇ ਦਾ ਕਤਲ ਕਰ ਦਿੰਦੀ ਹੈ ਉਹ ਸਿਚੁਏਸ਼ਨ ਹੀ ਇੱਦਾਂ ਦੀ ਹੁੰਦੀ ਆ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਟੈਰਰਿਸਟ ਪੈਦਾ ਨਹੀਂ ਹੁੰਦਾ ਉਸ ਨੂੰ ਹਾਲਾਤ ਬਣਾ ਦਿੰਦੇ ਆ ਪਹਿਲਾਂ ਜੋ ਟੈਰਰਿਸਟ ਬਣਿਆ ਸੀ ਉਹ ਪਹਿਲਾਂ ਬਹੁਤ ਵਧੀਆ ਇਨਸਾਨ ਸੀ ਜੋ ਪੜ੍ਹਦਾ ਸੀ ਚੰਗਾ ਲਿਖਦਾ ਸੀ ਪਰ ਉਸ ਨੂੰ ਹਾਲਾਤ ਉਹਨਾਂ ਦੇ ਹਾਲਾਤਾਂ ਨੇ ਉਸਨੂੰ ਟੈਰਰਿਸਟ ਬਣਾ ਦਿੱਤਾ ਕਿ ਉਸਦੀ ਪ੍ਰੇਮਿਕਾ ਦਾ ਮਤਲਬ ਰੇਪ ਕਰਕੇ ਉਸਨੂੰ ਸੁੱਟ ਦਿੱਤਾ ਉਸ ਨੂੰ ਮਾਰ ਦਿੱਤਾ ਗਿਆ ਇਸ ਲਈ ਉਹਦੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਉਹ ਟੈਰਰਿਸਟ ਬਣਿਆ ਅਤੇ ਉਸ ਦੀ ਵਾਈਫ ਜੋ ਅਨੀਤ ਸੀ ਪੁਲਿਸ ਅਫਸਰ ਦੀ ਉਹ ਮਤਲਬ ਵੀ ਬਹੁਤ ਸ਼ਹਿਨਸ਼ੀਲ ਔਰਤ ਉਹ ਕਿਤਾਬਾਂ ਪੜ੍ਹਦੀ ਸੀ ਉਹ ਲਿਟਰੇਚਰ ਨਾਲ ਜੁੜੀ ਹੋਈ ਸੀ ਉਸਨੂੰ ਫੁੱਲ ਬੂਟਿਆਂ ਨਾਲ ਕੁਦਰਤ ਨਾਲ ਬਹੁਤ ਪਿਆਰ ਸੀ ਅਤੇ ਉਹ ਬਹੁਤ ਯਕੀਨ ਕਰਦੀ ਸੀ ਆਪਣੇ ਹਸਬੈਂਡ 'ਤੇ ਪਰ ਜਦੋਂ ਉਸਦਾ ਯਕੀਨ ਟੁੱਟਦਾ ਹੈ ਉਸਨੂੰ ਆਪਣੇ ਪਤੀ ਦੀ ਹੈਵਾਨੀਅਤ ਦਿਸਦੀ ਹੈ ਤਾਂ ਉਸਦੇ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ ਕਿ ਉਸਦਾ ਕਤਲ ਕਰ ਦਿੰਦੀ ਹੈ ਇਸ ਲਈ ਵੀ ਹਾਲਾਤ ਬਣਾਉਂਦੇ ਨੇ ਬੰਦੇ ਨੂੰ ਟੈਰਰਿਸਟ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ